ਹੈਲੋ ਹਾਂਜੀ ਵੈਰੀ ਗੁੱਡ ਈਵਨਿੰਗ ਜੀ ਮੈਂ ਹਰਜਿੰਦਰ ਕੌਰ ਬੋਲ ਰਹੀ ਹਾਂ ਸੁਖਮਨੀ ਕਲੀਨਿਕ ਤੋਂ ਓਕੇ ਹਾਂਜੀ ਹਾਂਜੀ ਹਾਂਜੀ ਦੱਸੋ ਹਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਪਹਿਲਾਂ ਮੈਨੂੰ ਥੋੜ੍ਹਾ ਜਿਹਾ ਦੱਸੋ ਵੀ ਬੱਚੇ ਦਾ ਡੇਲੀ ਰੂਟੀਨ ਕੀ ਹੈ ਕਿਉਂ ਨਹੀਂ ਖਾ ਪੀ ਰਿਹਾ ਉਹਦਾ ਇੰਟਰਸਟ ਕੀ ਹੈ ਠੀਕ ਐ ਜੀ ਹਾਂਜੀ ਹੁੰ ਹੁੰ ਠੀਕ ਹੈ ਠੀਕ ਹੈ ਠੀਕ ਹੈ ਅਤੇ ਖਾਣ ਪੀਣ 'ਚ ਉਹਨੂੰ ਕੀ ਪਸੰਦ ਹੈ ਜ਼ਿਆਦਾ ਕੀ ਉਹਨੂੰ ਪ੍ਰੈਫਰ ਉਹ ਕਰਦਾ ਠੀਕ ਹੈ ਦੁੱਧ ਨੂੰ ਅਵੋਆਈਡ ਕਰਦਾ ਹਾਂਜੀ ਮੈਂ ਸਮਝ ਗਈ ਅਤੇ ਐਕਟਿਵ ਕਿਵੇਂ ਹੈ ਅੱਛਾ ਠੀਕ ਹੈ ਅਤੇ ਠੀਕ ਹੈ ਅਤੇ ਸੌਂਦਾ ਵਗੈਰਾ ਟਾਈਮ ਨਾਲ ਕਿਵੇਂ ਹੈ ਨੀਂਦ ਪ੍ਰੋਪਰ ਲੈ ਰਿਹਾ ਹਾਂ ਮੈਨੂੰ ਕਿਤੇ ਨਾ ਕਿਤੇ ਇਹ ਰੀਜਨ ਲੱਗ ਰਿਹਾ ਵੀ ਬੱਚਾ ਜਦੋਂ ਆਪਣੀ ਡਾਇਟ ਤੋਂ ਹਟ ਕੇ ਜ਼ਿਆਦਾ ਇੰਟਰਸਟ ਜਦੋਂ ਆਪਾਂ ਫੋਨ ਵੱਲ ਦਿੰਦੇ ਹਾਂ ਬੱਚਾ ਦਿੰਦਾ ਜਦੋਂ ਵੱ ਫੋਨ ਵੱਲ ਤਾਂ ਉਹਦਾ ਖਾਣ ਵੱਲ ਇੰਟਰਸਟ ਘੱਟ ਜਾਂਦਾ ਉਹ ਹੀ ਉਹਨੂੰ ਭੁੱਖ ਦਾ ਮਹਿਸੂਸ ਨਹੀਂ ਹੋ ਰਹੀ ਹੈ ਠੀਕ ਹੈ ਉਹ ਜ਼ਿਆਦਾ ਐਨਰਜੀ ਉੱਧਰ ਯੂਜ ਕਰ ਰਿਹਾ ਜਿਹਦੇ ਕਰਕੇ ਉਹ ਖਾ ਪੀ ਨਹੀਂ ਰਿਹਾ ਅਤੇ ਚਲੋ ਥੋੜ੍ਹੇ ਪਰਿਕੋਸ਼ਨਸ ਤੁਹਾਨੂੰ ਵੀ ਲੈਣੀਆਂ ਪੈਣਗੀਆਂ ਵੀ ਆਪਾਂ ਜਿੰਨਾ ਅਵੋਆਇਡ ਕਰ ਸਕੀਏ ਫੋਨ ਨੂੰ ਵੀ ਉੰਨਾ ਜ਼ਿਆਦਾ ਆਪਾਂ ਅਵੋਆਇਡ ਕਰੀਏ ਕਿਉਂਕਿ ਫੋਨ ਦੇ ਇੰਟਰਸਟ ਕਰਕੇ ਉਹ ਆਪਣੇ ਫੂਡ 'ਤੇ ਇੰਟਰਸਟ ਲੈ ਹੀ ਨਹੀਂ ਰਿਹਾ ਗਾ ਦੇਖੋ ਨਾ ਬੱਚਾ ਜਦੋਂ ਤੱਕ ਮਤਲਬ ਆਪਣੀ ਉਹਨੂੰ ਇੰਟਰਸਟ ਵਾਲੀ ਚੀਜ਼ ਵੱਲ ਉਹ ਜ਼ਿਆਦਾ ਐਟਰੈਕਟ ਹੋ ਰਿਹਾ ਖਾਣੇ ਵੱਲ ਉਹਦਾ ਧਿਆਨ ਹੀ ਨਹੀਂ ਨਾ ਹੀ ਉਹਨੂੰ ਭੁੱਖ ਮਹਿਸੂਸ ਹੋ ਰਹੀ ਹੈ ਨਾ ਹੀ ਉਹ ਖੇਡਣਾ ਚਾਅ ਰਿਹਾ ਅਤੇ ਉਹਦਾ ਫਿਜੀਕਲ ਅਤੇ ਮੈਂਟਲ ਡਿਵੈਲਪਮੈਂਟ ਦੋਨੋਂ ਹੀ ਰੁਕ ਚੁੱਕੇ ਆ ਅਤੇ ਕਈ ਹੱਦ ਤੱਕ ਮੈਂ ਸਮਝ ਸਕਦੀ ਹਾਂ ਵੀ ਪੇਰੈਂਟਸ ਵੀ ਜ਼ਿੰਮੇਵਾਰ ਇਸ ਚੀਜ਼ ਲਈ ਹਾਂਜੀ ਦੇਖੋ ਬੱਚਾ ਹਾਂਜੀ ਕੋਈ ਗੱਲ ਨਹੀਂ ਤੁਸੀਂ ਕਲੀਨਿਕ ਮੇਰਾ ਮੰਡੇ ਓਪਨ ਰਹੇਗਾ ਅਤੇ ਨੌ ਤੋਂ ਇੱਕ ਤੱਕ ਆ ਸਕਦੇ ਹੋ ਉਸ ਤੋਂ ਬਾਅਦ ਦੋ ਤੋਂ ਲੈ ਕੇ ਪੰਜ ਤੱਕ ਮੈਂ ਨਹੀਂ ਹੁੰਦੀ ਗੀ ਫਿਰ ਸਾਢੇ ਪੰਜ ਕਲੀਨਿਕ ਦੁਬਾਰਾ ਆ ਜਾਊਂ ਆ ਆ ਜਾਂਦੀ ਹਾਂ ਅਤੇ ਤੁਸੀਂ ਜਦੋਂ ਮਰਜ਼ੀ ਦਿਖਾ ਸਕਦੇ ਹੋ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਆਪਣੀ ਨੰਬਰ ਲੈ ਲਿਓ ਫੋਨ 'ਤੇ ਵੀ ਲੈ ਸਕਦੇ ਹੋ ਅਤੇ ਵਿਜਿਟ ਵੀ ਕਰ ਸਕਦੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਓਕੇ ਓਕੇ ਜੀ ਵੈਲਕਮ ਜੀ